ਖੁੱਲ੍ਹੇ ਪਾਣੀ ਵਿੱਚ ਤੈਰਨ ਲਈ ਸਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਜਿਵੇਂ ਕਿ ਸਾਨੂੰ ਤੈਰੀ ਨਾ ਆਉਂਦੀ ਹੋਵੇ ਤਾਂ ਅਸੀਂ ਸਾਨੂੰ ਡੂੰਘੇ ਪਾਣੀ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਉਸ ਵਿੱਚ ਕਈ ਜ਼ਹਿਰੀਲੇ ਪਦਾਰਥ ਵੀ ਹੁੰਦੇ ਹਨ ਜਿਵੇਂ ਕਿ ਸੱਪ ਵਗੈਰਾ ਵੀ ਹੋ ਜਾਂਦੇ ਹਨ ਜਿਵੇਂ ਕਿ ਸਾਨੂੰ ਕੋਈ ਵੀ ਸੱਟ ਲੱਗ ਸਕਦੀ ਆ ਅਤੇ ਸਾਨੂੰ ਅੱਗੇ ਡੂੰਗੇ ਪਾਣੀ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਥੱਲੇ ਦਲਦਲ ਵੀ ਹੋ ਸਕਦੀ ਹੈ ਜਿਸ ਕਾਰਨ ਸਾਡੇ ਪੈਰ ਨੀਚੇ ਫਸ ਜਾਣ 'ਤੇ ਸਾਡੀ ਮੌਤ ਵੀ ਹੋ ਸਕਦੀ ਹੈ ਇਸ ਕਰਕੇ ਸਾਨੂੰ ਡੂੰਗੇ ਪਾਣੀ 'ਚ ਨਹਾਉਣਾ ਨਹੀਂ ਚਾਹੀਦਾ ਹੈ ਅਤੇ ਸਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਇਸ ਕਰਕੇ ਸਾਨੂੰ ਪਾਣੀ ਵਿੱਚ ਤੈਰਦੇ ਸਮੇਂ ਬਹੁਤ ਸਾਰੇ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹਨ ਅਤੇ ਇਸ ਕਰਕੇ ਪਾਣੀ ਵਿੱਚ ਜਾਣ ਲਈ ਸਾਨੂੰ ਬਹੁਤ ਹੀ ਸਾਵਧਾਨੀ ਵਰਤਣੀ ਚਾਹੀਦੀ ਹੈ ਪਾਣੀ ਵਿੱਚ ਨਹਾਉਂਦੇ ਸਮੇਂ ਸਾਨੂੰ ਕਈ ਇਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕਈ ਜ਼ਹਿਰੀਲੀ ਜੜੀਆਂ ਬੂਟੀਆਂ ਵੀ ਹੁੰਦੀਆਂ ਹਨ ਜੋ ਕਿ ਸਾਨੂੰ ਕੁਝ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ ਇਸ ਕਰਕੇ ਸਾਨੂੰ ਪਾਣੀ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ